ਇਹ ਕਿਹਾ ਨਹੀਂ ਜਾ ਸਕਦਾ ਕਿ ਮੈਂ ਦੂਜਿਆਂ ਨਾਲੋਂ ਵਧੀਆ ਕੰਮ ਫੋਟੋਗ੍ਰਾਫੀ ਵਿੱਚ ਕਰਦਾ ਹਾਂ ਪਰ ਹਾਂ ਮੈਂ ਇੰਨਾ ਆਪਣੇ 'ਤੇ ਭਰੋਸਾ ਕਰਦਾ ਹਾਂ ਕਿ ਜੋ ਮੈਨੂੰ ਕੰਮ ਦਿੱਤਾ ਜਾਂਦਾ ਹੈ ਫੋਟੋਗ੍ਰਾਫੀ ਵਿੱਚ ਉਹ ਮੈਂ ਬਹੁਤ ਹੀ ਚੰਗੇ ਤਰੀਕੇ ਨਾਲ ਅਤੇ ਟਾਈਮ ਸਿਰ ਦਿੰਦਾ ਹਾਂ ਫੋਟੋਗ੍ਰਾਫੀ ਦੇ ਵਿੱਚ ਕਈ ਇਹੋ ਜਿਹੇ ਕਈ ਇਹ ਜਿਹੇ ਪਾਟਸ ਆਉਂਦੇ ਹਨ ਪੁਆਇੰਟਸ ਆਉਂਦੇ ਹਨ ਜਿਸ ਜਿਸ ਜਿਸ ਨਾਲ ਸਾਨੂੰ ਪਤਾ ਲੱਗ ਸਕਦਾ ਹੈ ਕਿ ਇੱਕ ਚੰਗਾ ਫੋਟੋਗ੍ਰਾਫ ਬਣਨ ਲਈ ਕਿਸ ਕਿਸ ਕਿਸ ਕਿਸ ਮਹੱਤਤਾ ਦੀ ਲੋੜ ਹੈ ਅਤੇ ਅਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਫੋਟੋਗ੍ਰਾਫੀ ਦੇ ਵਿੱਚ ਦੋ ਸਾਲ ਹੋ ਚੱਲੇ ਹਨ ਮੈਂ ਹੋਰ ਅੱਗੇ ਵੀ ਹੋਰ ਸਿੱਖ ਸਿੱਖ ਰਿਹਾ ਹਾਂ ਕਿ ਕਿਵੇਂ ਇੱਕ ਚੰਗੀ ਫੋਟੋਗ੍ਰਾਫ ਖਿੱਚ ਖਿੱਚ ਕੇ ਖਿੱਚ ਸਕਦੇ ਹਨ ਜਿਸ ਵਿੱਚ ਸਾਨੂੰ ਸਾਹਮਣੇ ਦਿਖਾਈ ਹੋਈ ਤਸਵੀਰ ਹੋਰ ਵੀ ਚੰਗੀ ਤਰੀਕੇ ਨਾਲ ਬਣ ਕੇ ਦਿਖਦੀ ਫੋਟੋਗਰਾਫ ਵਿੱਚ ਦਿਖਦੀ ਹੈ ਅਤੇ ਜੇ ਗੱਲ ਕਰੀਏ ਕਿ ਦੂਜਿਆਂ ਤੋਂ ਤੁਹਾਡਾ ਕੰਮ ਕਿਵੇਂ ਵਿਲੱਖਣ ਹੈ ਤਾਂ ਮੈਂ ਕਈ ਕਈ ਵਾਰ ਆਪਣੇ ਕੈਮਰਾ ਵਿੱਚ ਕੁਛ ਇਹੋ ਜਿਹੇ ਨਵੇਂ ਲੈਂਸ ਲਗਾਉਂਦਾ ਹਾਂ ਫਿਲਟਰ ਲਗਾਉਂਦਾ ਹਾਂ ਜਿਸ ਨਾਲ ਫੋਟੋਗਰਾਫ ਫੋਟੋਗ੍ਰਾਫੀ ਵਿੱਚ ਹੋਰ ਵੀ ਚੰਗੇ ਇਫੈਕਟ ਬਣ ਜਾਂਦੇ ਹਨ ਅਤੇ ਕਈ ਵਾਰੀ ਮੈਂ ਬਿਨਾਂ ਹੀ ਫਿਲਟਰ ਤੋਂ ਕੈਮਰੇ ਉੱਤੇ ਚੰਗੀਆਂ ਫੋਟੋਆਂ ਤਸਵੀਰਾਂ ਖਿੱਚਦਾ ਹਾਂ ਅਤੇ ਇਹ ਇਹ ਜ਼ਿਆਦਾਤਰ ਇਕ ਹੋਰ ਜ਼ਿਆਦਾਤਰ ਹੋਰ ਕੋਈ ਫੋਟੋਗ੍ਰਾਫਰ ਨਹੀਂ ਕਰਦਾ ਪਰ ਜਿਵੇਂ ਮੈਂ ਕਹਿ ਰਿਹਾ ਹਾਂ ਕਿ ਮੇਰਾ ਹਜੇ ਇਸ ਵਿੱਚ ਸ਼ੁਰੂਆਤੀ ਦੌਰ ਹੈ ਪਰ ਮੈਂ ਆਉਂਦੇ ਆਉਂਦੇ ਅਗਲੇ ਕੁਛ ਸਮੇਂ ਵਿੱਚ ਚੰਗੇ ਤਰੀਕੇ ਨਾਲ ਫੋਟੋਗ੍ਰਾਫੀ ਸਿੱਖੂਗਾ ਧੰਨਵਾਦ